ਘਰ ਦੇ ਵਿੱਚ ਖਾਣਾ ਬਣਾਉਣ ਐਲਪੀਜੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਸਾਨੂੰ ਕੁਝ ਸਵਧਾਨੀਆਂ ਵਰਤਣੀ ਚਾਹੀਦੀ ਹੈ ਜਿਵੇਂ ਕੀ ਗੈਸ ਚੁਲੇ ਨੂੰ ਸਮੇਂ ਸਿਰ ਸਫਾਈ ਕਰਨੀ ਚਾਹੀਦੀ ਹੈ ਪਾਈਪ ਉਹਦਾ ਚੈੱਕ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਰੈਗੂਲੇਟਰ ਬਿਲਕੁਲ ਸਹੀ ਹੋਵੇ ਤੇ ਰੈਗੂਲੇਟਰ ਨੂੰ ਜਦੋਂ ਗੈਸ ਦੀ ਵਰਤੋਂ ਬੰਦ ਹੋ ਜਾਏ ਤੋ ਰੈਗੂਲੇਟਰ ਨੂੰ ਸਾਨੂੰ ਬੰਦ ਕਰ ਦੇਣਾ ਚਾਹੀਦਾ ਹੈ ਤੇ ਜਦੋਂ ਜਰੂਰਤ ਹੋਵੇ ਫਿਰ ਰੈਗੂਲੇਟਰ ਨੂੰ ਸਟਾਰਟ ਕਰਕੇ ਫਿਰ ਹੀ ਗੈਸ ਬਾਲਣੀ ਚਾਹੀਦੀ ਹੈ ਇਸ ਕਰਕੇ ਸਾਨੂੰ ਸੁਰੱਖਿਆ ਦੇ ਵਿੱਚ ਰਹਿ ਸਕਦਾ ਹੈ ਤੇ ਪਾਈਪ ਜਿਹੜੀ ਹੈ ਉਸ ਨੂੰ ਚੇਂਜ ਕਰਨ ਵੇਲੇ ਸਾਲ ਦਾ ਸਮਾਂ ਹੁੰਦਾ ਸਾਲ ਦੇ ਵਿੱਚ ਇੱਕ ਵਾਰੀ ਪਾਈਪ ਜਰੂਰ ਚੇਂਜ ਕਰਨਾ ਚਾਹੀਦਾ ਔਰ ਆਪਣੇ ਐਲਪੀਜੀ ਆਪਰੇਟਰ ਨਾਲ ਕੰਸਲਟ ਕਰਕੇ ਉਹਨੂੰ ਚੈੱਕ ਕਰਵਾਉਂਦਾ ਰਹਿਣਾ ਚਾਹੀਦਾ ਬਾਰ ਬਾਰ ਕੀ ਉਹ ਚੋਂ ਕੋਈ ਪ੍ਰੋਬਲਮ ਤੇ ਨਹੀਂ ਆ ਰਹੀ ਜਿਸ ਨੂੰ ਅਗਰ ਕੋਈ ਹੈ ਤੇ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਐਲਪੀਜੀ ਦੀ ਸੁਰੱਖਿਆ ਵਾਸਤੇ ਸਾਨੂੰ ਟਾਈਮਲਾਈਨ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ